ਟੈਕਨੋਲ ਟੈਕਨੋਲਜੀ ਨੇ ਨੌਕਰੀਆਂ ਦੇ ਦਾਇਰੇ ਨੂੰ ਵਧਾਉਣ ਵਿੱਚ ਬਹੁਤ ਮਦਦ ਕੀਤੀ ਹੈ ਜਿਵੇਂ ਕਿ ਆਪਾਂ ਆਨਲਾਈਨ ਨੌਕਰੀਆਂ ਦੇਖ ਸਕਦੇ ਹਾਂ ਅਤੇ ਇਹਨਾਂ ਇਹਨਾਂ ਨੌਕਰੀਆਂ ਨੂੰ ਅਸੀਂ ਜੁਆਇਨ ਕਰ ਸਕਦੇ ਹਾਂ ਫਾਰਮ ਭਰ ਸਕਦੇ ਹਾਂ ਆਨਲਾਈਨ ਜਿਵੇਂ ਕਿ ਇੰਜੀਨੀਅਰ ਡਾਕਟਰ ਨਰਸ ਪੁਲਿਸਮੈਨ ਰਾਈਟਰ ਟੀਚਰ ਡਾਂਸਰ ਪੋਸਟਮੈਨ ਆਦਿ ਇਹ ਨੌਕਰੀਆਂ ਨੌਕਰੀਆਂ ਦੇ ਵਿੱਚ ਭਰਤੀ ਕਰ ਸਕਦੇ ਹਾਂ ਇਸ ਲਈ ਇਹ ਨੌਕਰੀਆਂ ਅਸੀਂ ਘਰ ਬੈਠੇ ਫਾਰਮ ਭਰ ਕੇ ਇਹਨਾਂ ਨੌਕਰੀਆਂ ਨੌਕਰੀਆਂ ਵਿੱਚ ਹਿੱਸਾ ਲੈ ਸਕਦੇ ਹਾਂ ਅਤੇ ਅਸੀਂ ਵਿਗਿਆਨ ਦੇ ਤੌ ਵਿਗਿਆਨ ਦੇ ਤੌਰ 'ਤੇ ਜਿਵੇਂ ਕਿ ਵਿਗਿਆਨ ਨੇ ਬਹੁਤ ਸਾਰੀ ਮਸ਼ੀਨਾਂ ਬਣਾਈਆਂ ਹਨ ਇਸ ਇਸ ਤਰ੍ਹਾਂ ਅਸੀਂ ਘਰ ਬੈਠੇ ਕੁਝ ਵੀ ਕਰ ਸਕਦੇ ਹਾਂ ਅਤੇ ਸਾਰਾ ਕੰਮ ਕਰਨਾ ਆਸਾਨ ਹੋ ਗਿਆ ਹੈ ਅਤੇ ਇਹਨਾਂ ਹੀ ਨੌਕਰੀਆਂ ਦੇ ਕਾਰਨ ਸਾਨੂੰ ਘਰ ਬੈਠੇ ਕੋਈ ਵੀ ਨੌਕਰੀ ਜਿਹੜੀ ਉਹ ਭਰ ਸਕਦੇ ਹਾਂ ਅਤੇ ਜੁਆਇਨ ਕਰ ਸਕਦੇ ਹਾਂ ਇਹਨਾਂ ਨੌਕਰੀਆਂ ਇਹਨਾਂ ਨੌਕਰੀਆਂ ਦੇ ਵਿੱਚ ਕਾਰਨ ਸਾਨੂੰ ਬਹੁਤ ਫ਼ਾਇਦਾ ਹੋਇਆ ਹੈ ਜੋ ਕਿ ਟੈਕਨੋਲਜੀ ਸਾਡੇ ਲਈ ਬਹੁਤ ਫ਼ਾਇਦੇਮੰਦ ਰਹੀ ਹੈ ਘੱਟ ਸਮਾਂ ਲੱਗਦਾ ਹੈ ਆਦਿ ਇਸ ਇਸ ਲਈ ਸਾਨੂੰ ਨੌਕਰੀਆਂ ਆਨਲਾਈਨ ਕਰ ਆਨਲਾਈਨ ਕਰ ਸਕਦੇ ਹਾਂ